ਮੈਂ ਆਪਣੀ ਭੈਣ ਜਾਂ ਦੋਸਤ ਨੂੰ ਮਤਲਬ ਕਿ ਸਿੱਖਿਆ ਵੱਧ ਤੋਂ ਵੱਧ ਪੂਰੀ ਕਰਨਾ ਚਾਹੁੰਦਾ ਦੇਖਣਾ ਚਾਹੁੰਦਾ ਹਾਂ ਜਿਵੇਂ ਕਿ ਅੱਜ ਕੱਲ੍ਹ ਦੇਖਿਆ ਜਾਂਦਾ ਕਿ ਲੋਕ ਕੁੜੀਆਂ ਨੂੰ ਬਾਰਵੀਂ ਵੀ ਨਹੀਂ ਪਾਸ ਕਰਵਾਉਂਦੇ ਪਰ ਮੈਂ ਚਾਹੁੰਦਾ ਹਾਂ ਕਿ ਕੁੜੀਆਂ ਐਟ ਲਿਸ਼ ਗ੍ਰੈਜੂਏਸ਼ਨ ਤਾਂ ਕਰਨ ਤਾਂ ਕਿ ਆਪਣੇ ਪੈਰ 'ਤੇ ਖੜ੍ਹੇ ਹੋ ਸਕਣ ਆਉਣ ਵਾਲੇ ਟਾਈਮ 'ਚ ਕਿਸੇ 'ਤੇ ਨਿਰਭਰ ਨਾ ਰਹਿਣ ਕਿਸੇ 'ਤੇ ਉਹਨਾਂ ਵਿੱਚ ਡਿਪੈਂਡੈਂਸੀ ਨਾ ਹੋਵੇ ਉਹ ਆਪਣਾ ਆਪ ਕਰ ਸਕਣ ਤਾਂ ਜੋ ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਅਤੇ ਉਹਨਾਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਰਜਾ ਦੇਣਾ ਚਾਹੀਦਾ ਅੱਜ ਕੱਲ੍ਹ ਦੇਖਿਆ ਜਾ ਰਿਹਾ ਕਿ ਕੁੜੀਆਂ ਨੂੰ ਪੜ੍ਹਾਉਣ ਦੇ ਮਾਮਲੇ ਵਿੱਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਲੋਕ ਕਹਿੰਦੇ ਨੇ ਕੁੜੀ ਹੈ ਕੀ ਪੜ੍ਹਾਉਣਾ ਬਾਹਰ ਦਸਵੀਂ ਕਰਾ ਕੇ ਛੱਡ ਦਿਉ ਬਾਅਦ 'ਚੋਂ ਬੇਗਾਨੇ ਘਰ ਚੱਲ ਜਾਣਾ ਪਰ ਸਾਨੂੰ ਇਹ ਸੋਚ ਨਹੀਂ ਰੱਖਣੀ ਚਾਹੀਦੀ ਸਾਨੂੰ ਆਪਣੀ ਸੋਚ ਵਧੀਆ ਰੱਖਣੀ ਚਾਹੀਦੀ ਕਿ ਹਾਂ ਕੁੜੀਆਂ ਨੂੰ ਵੀ ਪੜ੍ਹਨ ਦਾ ਹੱਕ ਆ ਤਾਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਪੜ੍ਹਨ ਦੇਣਾ ਚਾਹੀਦਾ ਤਾਂ ਕਿ ਉਹ ਵੀ ਦੇਸ਼ ਦੀ ਪ੍ਰਗਤੀ ਵਿੱਚ ਮਦਦ ਕਰ ਸਕਣ ਕਿਉਂਕਿ ਕੁੜੀਆਂ ਵੀ ਅੱਜ ਕੱਲ੍ਹ ਦੇਖਿਆ ਜਾ ਰਿਹਾ ਕਿ ਕਾਫ਼ੀ ਹਾਈ ਪੋਸਟ 'ਤੇ ਜਾ ਰਹੀਆਂ ਵਾ ਕੋਈ ਆਈ ਏ ਐੱਸ ਔਫੀਸਰ ਬਣ ਰਿਹਾ ਕੋਈ ਨੇਵੀ ਦੀ ਤਿਆਰੀ 'ਚ ਲੱਗੀਆਂ ਹੋਈਆਂ ਅੱਜ ਕੱਲ੍ਹ ਵੂਮਨ ਇੰਡੀਅਨ ਕ੍ਰਿਕਟ ਟੀਮ ਵੀ ਆ ਗਈ ਹੋਈ ਹੈ ਠੀਕ ਹੈ ਨਾ ਅਤੇ ਸਾਨੂੰ ਕੁੜੀਆਂ ਨੂੰ ਵੀ ਬਰਾਬਰ ਦਰਜਾ ਦੇਣਾ ਚਾਹੀਦਾ ਪੜ੍ਹਾਈ ਲਿਖਾਈ ਵਿੱਚ